ਹੈਲੋ ਹੈਲੋ ਹਾਂਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਦੱਸੋ ਕਿਹੜੇ ਸਕੂਲ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਸਰਕਾਰੀ ਜਾਂ ਪ੍ਰਾਈਵੇਟ ਕਿਹੜੇ ਸਰਕਾਰੀ ਤਾਂ ਦੇਖੋ ਜੀ ਇਹ ਡਿਸਟ੍ਰਿਕਟ 'ਚ ਕਈ ਸਕੂਲ ਆ ਜਿੱਦਾਂ ਕਿ ਜਿਹੜੇ ਸ਼ਹਿਰ ਚ ਅਸੀਂ ਸਕੂਲ ਦੇਖੀਏ ਤਾਂ ਇਥੇ ਗੌਰਮੈਂਟ ਸੀਨੀਅਰ ਸਕੈਂਡਰੀ ਸਕੂਲ ਕੈਟਾਗਰ ਆ ਹੋਰ ਆਪਣਾ ਤੁਹਾਨੂੰ ਹੋਰ ਆਪਣਾ ਤੁਹਾਨੂੰ ਬਾਕੀ ਪਿੰਡਾਂ ਚੋਂ ਵੀ ਮਿਲੂਗਾ ਜਿੱਦਾਂ ਕਿ ਬੋਂਡ ਪੱਟੀ ਸਕੂਲ ਹੈਗਾ ਵਾ ਪਥਿਆਲ ਇੱਕ ਸਕੂਲ ਹੈਗਾ ਵਾ ਮਤਲਵ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸਕੂਲ ਤੁਹਾਨੂੰ ਮਿਲਜੂਗੇ ਸਰਕਾਰੀ ਤਾਂ ਫੀਸ ਤਾਂ ਭਾਅ ਜੀ ਦੇਖੋ ਮੈਨੂੰ ਐਗਜੈਕਟਲੀ ਨਹੀਂ ਪਤਾ ਪਰ ਆ ਉਹੀ ਮਤਲਬ ਮਹੀਨੇ ਦੀ ਦੇਖਿਆ ਜਾਵੇ ਸੱਤਰ ਅੱਸੀ ਰੁਪਏ ਹੁੰਦੀ ਆ ਨੌਵੀਂ ਦਸਵੀਂ ਦੇ ਨਿਆਣੇ ਦੀ ਐਡਮਿਸ਼ਨ ਫੀਸ ਤਿੰਨ ਸੋ ਰੁਪਈਆ ਹਾਂਜੀ ਹਾਂਜੀ ਹਾਂਜੀ ਹਾਂਜੀ ਪੜਹਾਈ ਜੀ ਠੀਕ ਹੁੰਦੀ ਆ ਮਤਲਬ ਪ੍ਰਾਈਵੇਟ ਸਕੂਲਾਂ ਦੇ ਹਿਸਾਬ ਨਾਲ ਦੇਖਿਆ ਥੋੜਾ ਤਾ ਲੈਵਲ ਡਾਊਨ ਹੁੰਦਾ ਹੀ ਹੈ ਜੀ ਠੀਕ ਹੁੰਦੀ ਪ੍ਰਾਈਵੇਟ ਕਿਹੜੇ ਪੰਜਾਬ ਬੋਰਡ ਸੀ ਬੀ ਐਸ ਈ ਆਈ ਸੀ ਐਸ ਸੀ ਕਿਹੜੇ ਪੰਜਾਬ ਬੋਰਡ ਇੱਥੇ ਤੁਹਾਨੂੰ ਵਿੱਦਿਆ ਮੰਦਿਰ ਮਿਲ ਜਾਊਗਾ ਹੋਰ ਆਪਣਾ ਤੁਹਾਨੂੰ ਟੋਡਰ ਹੋਮਸ ਮਿਲ ਜਾਊਗਾ ਹੋਰ ਆਪਣਾ ਐਸ ਡੀ ਸਕੂਲ ਮਿਲ ਜਾਊਗਾ

ਇਹਨਾਂ ਦੀ ਦੇਖੋ ਵਧੀਆ ਇਹਨਾਂ ਦੇ ਵਿੱਚ ਵੀ ਇਦਾਂ ਮਾੜਾ ਤਾਂ ਨਹੀਂ ਹੈਗਾ ਇਹਨਾਂ ਦਾ ਮੈਨੂੰ ਨੌਲੇਜ ਨਹੀਂ ਉਹੀ ਸੱਤ ਅੱਠ ਸੋ ਤੱਕ ਹੋਊਗੀ ਮੇਰੇ ਖਿਆਲ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਸੱਤ ਅੱਠ ਸੋ ਹਜਾਰ ਬਾਰਾਂ ਸੋ ਐਨੇ ਕ ਤੱਕ ਇਸ ਤੋਂ ਵੱਧ ਹੋਣ ਵੀ ਨੀ ਵਾਲੀ ਹਾਂਜੀ ਹਾਂਜੀ ਮਹੀਨੇ ਦੀ ਸੀ ਬੀ ਐਸ ਸੀ ਦੇਖੋ ਜੀ ਇਹ ਸਕੂਲ ਤੁਹਾਨੂੰ ਮਹਿੰਗੇ ਪੈਣੇ ਫਾਈਨੈਸ਼ੀਅਲੀ ਪਰ ਮੈਂ ਦੱਸ ਦਿੰਨਾ ਇੱਕ ਤੁਹਾਨੂੰ ਮਿਲ ਜਾਊਗਾ ਐਸ ਡੀ ਸੀ ਟੀ ਪਬਲਿਕ ਆਦਮ ਵਾਲਾ ਵੁਡਲੈਂਡ ਓਵਰਸੀਜ ਸਕੂਲ ਆ ਔਰ ਆਪਣਾ ਜੀ ਐਮ ਏ ਸਿਟੀ ਪਬਲਿਕ ਆ ਹੋਰ ਜੈਂਮਕੈਂਬਰੇਜ ਆ ਹੋਰ ਤਰਾਂ ਤਰਾਂ ਦੇ ਸਕੂਲ ਆ ਸਪੀਨੀਟੀ ਆਈ ਸੀ ਐਸ ਸੀ ਚ ਆ ਜਾਂਦਾ ਹੈ ਜੀ ਸੀ ਬੀ ਐਸ ਈ ਵਾਲੇ ਸਕੂਲ ਵਧੀਆ ਇਹਨਾਂ ਦੀ ਮਤਲਬ ਹਰੇਕ ਤਰ੍ਹਾਂ ਦੀਆਂ ਚੀਜ਼ਾਂ ਇਹ ਕਰਾਦੇ ਤੁਹਾਨੂੰ ਕੂਲ ਐਕਟੀਵਿਟੀਜ਼ ਵੀ ਕਰਾਉਗੇ ਇਹ ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ ਕਰਵਾਉਂਦੇ ਆ ਪੜ੍ਹਾਈ ਵੀ ਵਧੀਆ ਆ ਇਹਨਾਂ ਦੀ ਇਹਨਾਂ ਦੀ ਭਾਅ ਜੀ ਇਹਨਾਂ ਦੀ ਮਹਿੰਗੀ ਹੋਣੀ ਇਹ ਸੀ ਬੀ ਐਸ ਈ ਵਾਲਿਆਂ ਦੀ ਮੈਨੂੰ ਐਗਜੈਕਟਲੀ ਨਹੀਂ ਪਤਾ ਪਰ ਐਸਟੀਮੇਟ ਲਗਾ ਕੇ ਦੱਸ ਦਿੰਨਾ ਦੋ ਕ ਹਜਾਰ ਤੱਕ ਤਾਂ ਹੋਊਗੀ ਪਰ ਮੰਥ ਦੋ ਢਾਈ ਤੱਕ ਮੇਰੇ ਹਿਸਾਬ ਨਾਲ ਤਾਂ ਹਾਂਜੀ ਹਾਂਜੀ ਗੁਡਲੈਂਡ ਸਕੂਲ ਹੈ ਤਾਂ ਵਧੀਆ ਪਰ ਕਾਸਟਲੀ ਆ ਮੇਰਾ ਕਜ਼ਨ ਬਰਦਰ ਪੜਦਾ ਉਥੇ ਕੋਸਟਲੀ ਆ ਟਰਿਪਲ ਐਮ ਹਾਂਜੀ ਟਰਿਪਲ ਐਮ ਤਾਂ ਹਜੇ ਨਵਾਂ ਨਵਾਂ ਈ ਖੁੱਲਿਆ ਐ ਜੀ ਉਹਨਾਂ ਦੇ ਕੋਚਿੰਗ ਸੈਂਟਰ ਵੀ ਨਵਾਂ ਖੁੱਲਿਆਂ ਈ ਆ ਇਸ ਸਾਲ ਈ ਖੁੱਲਿਆ ਉਹ ਤਾਂ ਹਜੇ ਸ਼ੁਰੂ ਹੋਇਆ ਈ ਨੀ ਮੇਰੇ ਖਿਆਲ ਨਾਲ ਆਈ ਸੀ ਐੱਸ ਈ ਜੀ ਸੈਹਟ ਜੋਸਫ ਮਾਊਂਟ ਕਾਰਮਲ ਚੈਨਟੀ ਆ

ਇਹਦੀ ਵਧੀਆ ਇਹਨਾਂ ਦੀ ਪੜਾਈ ਟਫ ਹੁੰਦੀ ਮਤਲਵ ਬੱਚੇ ਨੂੰ ਇੱਕ ਲੈਵਲ ਸੈੱਟ ਰੱਖਦੀਆਂ ਵਾਂ ਇਹਨਾਂ ਦੀ ਫੀਸ ਸੀ ਬੀ ਐਸ ਈ ਜਿੰਨੀ ਹੋਣੀ ਹੈ ਸੀ ਬੀ ਐਸ ਈ ਤੋਂ ਥੋੜੇ ਘੱਟ ਹੋ ਸਕਦੀ ਪਰ ਜਿਆਦਾ ਤਾਂ ਨਹੀਂ ਹੋਊਗੀ ਮੇਰੇ ਅਕੋਡਿੰਗਲੀ ਦੇਖੋ ਜੀ ਅਗਰ ਤੁਸੀਂ ਬੱਚੇ ਨੂੰ ਪੜਾਈ 'ਚ ਵਧੀਆ ਬਿਲਡ ਕਰਨਾ ਤਾਂ ਆਈ ਸੀ ਐਸ ਸੀ ਦੀ ਕੋਈ ਰੀਸ ਈ ਹੈਨੀ ਕਿਉਂਕਿ ਉਹ ਬੱਚੇ ਨੂੰ ਹਰੇਕ ਹਸਣ ਲਈ ਤਿਆਰ ਕਰਦੇ ਹਰੇਕ ਮਤਲਬ ਜਿੱਦਾਂ ਜੇ ਬੱਚਾ ਉਥੇ ਫੇਲ ਆ ਤਾਂ ਉਹ ਫੇਲ ਹੀ ਆ ਜਿੱਦਾਂ ਸੀ ਬੀ ਐਸ ਈ ਵਾਲੇ ਪਾਸ ਕਰ ਦਿੰਦੇ ਪੰਜਾਬ ਬੋਰਡ ਵਾਲੇ ਪਾਸ ਦਿੰਦੇ ਪਰ ਆਈ ਸੀ ਐਸ ਈ ਸਹਿਜੇ ਕੀਤੇ ਪਾਸ ਨੀ ਕਰਦਾ ਬੱਚੇ ਨੂੰ ਹਾਂਜੀ ਓਕੇ ਓਕੇ